ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂ ਠੀਕ ਹੈ ਤੁਸੀਂ ਪਟਿਆਲੇ ਤੋਂ ਸਿੱਧੀ ਮੋਹਾਲੀ ਵਾਲੀ ਬੱਸ ਸਟੈਂਡ ਵਾਲੀ ਬੱਸ ਲੈ ਲੈਣੀ ਹੈ ਜਦੋਂ ਤੁਸੀਂ ਬੱਸ ਸਟੈਂਡ ਪਹੁੰਚ ਗਏ ਉੱਥੋ ਤੁਸੀਂ ਅੱਠ ਫੇਜ਼ ਲਈ ਔਟੋ ਲੈ ਲੈਣਾ ਠੀਕ ਹੈ ਜੀ ਜਦੋਂ ਤੁ ਔਟੋ ਨੇ ਸਿੱਧਾ ਤੁਹਾਨੂੰ ਪੰਜਾਬ ਬੋਰਡ ਐਜੂਕੇਸ਼ਨ ਵਾਲੀ ਬਿਲਡਿੰਗ ਦੇ ਅੱਗੇ ਉਤਾਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਜਦੋਂ ਅੰਦਰ ਜਾਊਂਗੇ ਨਾ ਉੱਥੇ ਕਿਸੇ ਮਰਜ਼ੀ ਨੂੰ ਵੀ ਪੁੱਛ ਲਿਓ ਤੁਹਾਨੂੰ ਉਹ ਬਲੋਕ ਦੱਸ ਦੇਣਗੇ ਜਿਹੜਾ ਵੀ ਤੁਹਾਡਾ ਕੰਮ ਹੈ ਨਾ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਨਾਮ ਚੇਜ਼ ਮਿਸਟੇਕ ਹੈ ਹਾਂਜੀ ਅਤੇ ਫਿਰ ਉਹ ਤੁਹਾਨੂੰ ਦੱਸ ਦੇਣਗੇ ਅਗਰ ਕੋਈ ਫਿਰ ਵੀ ਜ਼ਰੂਰਤ ਪਈ ਨਾ ਫਿਰ ਤੁਸੀਂ ਮੈਨੂੰ ਕੋਲ ਕਰ ਸਕਦੇ ਆ ਠੀਕ ਹੈ ਨਾ ਕੋਈ ਰਸਤੇ 'ਚ ਪ੍ਰੋਬਲਮ ਆਈ ਕੁਛ ਵੀ ਦਿੱਕਤ ਆਵੇ ਕੋਈ ਵੀ ਫਿਰ ਤੁਸੀਂ ਮੈਨੂੰ ਕੋਲ ਕਰ ਲਿਓ ਠੀਕ ਹੈ ਜੀ